ਪੰਜਾਬ ਵਿੱਚ ਸਭ ਤਰ੍ਹਾਂ ਦੇ ਜਿਹੜੇ ਟੈਕਨੋਲਜੀ ਸੈਕਟਰ ਜਾਂ ਜਿਹੜੇ ਉਦਯੋਗ ਹੈ ਉਹ ਮੌਜੂਦ ਹਨ ਪਰੰਤੂ ਜਿਹੜਾ ਪੰਜਾਬ ਹੈ ਉਹ ਉਸ ਜਿਹੜਾ ਪੰਜਾਬ ਹੈ ਉਹ ਖੇਤੀ ਲਈ ਜ਼ਿਆਦਾ ਜਾਣਿਆ ਜਾਂਦਾ ਜਾ ਜਾਣਿਆ ਜਾਂਦਾ ਹੈ ਆਹ ਪੰਜਾਬ ਦੀ ਧਰਤੀ ਵਿੱਚ ਜਿਹੜਾ ਖਾਣੇ ਦੀ ਕਦੀ ਘਾਟ ਨਹੀਂ ਹੁੰਦੀ ਇੱਥੇ ਬਹੁਤ ਤਰ੍ਹਾਂ ਦਾ ਜਿਹੜਾ ਖਾਣਾ ਹੈ ਅਨਾਜ ਹੈ ਉਹ ਉਗਾਇਆ ਜਾਂਦਾ ਹੈ ਅਤੇ ਇਸ ਕਾਰਨ ਜਿਹੜਾ ਇਸ ਪੰਜਾਬ ਵਿੱਚ ਜਿਹੜਾ ਉਦਯੋਗ ਹੈ ਉਹ ਐਗਰੋ ਬੇਸਡ ਜਿਹੜੀ ਇੰਡਸਟਰੀਜ ਉਹ ਜ਼ਿਆਦਾ ਵਿਕਸਤ ਹਨ ਕਿਉਂਕਿ ਜਿਵੇਂ ਜਿਹੜਾ ਪੰ ਜਿਹੜਾ ਆਪਾਂ ਝੋਨਾ ਉਗਾਉਂਦੇ ਹਾਂ ਉਹਦੇ ਵਿੱਚ ਜਿਵੇਂ ਫਰਟੀਲਾਈਜਰ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਅਤੇ ਜਿਹੜੀ ਪੰਜਾਬ ਵਿੱਚ ਬਹੁਤ ਜ਼ਿਆਦਾ ਅਮਾਊਂਟ ਵਿੱਚ ਜਿਹੜਾ ਹੈ ਜਿਹੜਾ ਆ ਫਰਟੀਲਾਈਜ਼ਰ ਹੈ ਉਹ ਬਣਾਇਆ ਜਾਂਦਾ ਹੈ ਅਤੇ ਉਹਦੀ ਇੰਡਸਟਰੀਜ਼ ਹੈ ਉਹ ਬਹੁਤ ਚੱਲਦੀਆਂ ਹਨ ਅਤੇ ਓ ਪੰਜਾਬ ਵਿੱਚ ਹੋਰ ਕਈ ਅਲੱਗ ਅਲੱਗ ਜਿਹੜੇ ਆਪਣੇ ਸ਼ਹਿਰ ਹੈ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਇੰਡਸਟਰੀਜ਼ ਆ ਜਿਵੇਂ ਲੁਧਿਆਣਾ ਸ਼ਹਿਰ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਹੌਜ਼ਰੀ ਦਾ ਹੌਜ਼ਰੀ ਦਾ ਕੰਮ ਹੌਜ਼ਰੀ ਦੀ ਜਿਹੜੀਆਂ ਇੰਡਸਟਰੀਜ ਹੈ ਉਹ ਡਿਵਲਪਡ ਹਨ ਉਹ ਵਿਕਸਤ ਹਨ ਜਿਵੇਂ ਗਾਰਮੈਂਟਸ ਕੱਪੜਾ ਬਣਾਉਣਾ ਜਿਵੇਂ ਜਲੰਧਰ ਵਿੱਚ ਜਿਹੜਾ ਸਪੋਰਟਸ ਦਾ ਜਿਹੜਾ ਆਪਣਾ ਇੰਡਸਟਰੀ ਦਾ ਸਪੋਰਟਸ ਇੰਡਸਟਰੀਜ ਹੈ ਉਹ ਜ਼ਿਆਦਾ ਵਿਕਸਤ ਹਨ ਕਪੂਰਥਲਾ ਵਿੱਚ ਰੇਲਵੇ ਕੋਚ ਦੀ ਆ ਜਿਹੜੀ ਵੱਡੀ ਇੰਡਸਟਰੀ ਹੈ ਉਹ ਕਪੂਰਥਲਾ ਵਿੱਚ ਮੌਜੂਦ ਹੈ ਜਿੱਥੇ ਜਿਹੜੇ ਰੇਲਵੇ ਦੇ ਹੈ ਰੇਲਵੇ ਦੇ ਜਿਹੜੇ ਅਲੱਗ ਅਲੱਗ ਪਾਰਟਸ ਹੈ ਉਹਨਾਂ ਦੀ ਆਹਾ ਰਚਨਾ ਕੀਤੀ ਜਾਂਦੀ ਹੈ ਅਤੇ ਪੰਜਾਬ ਵਿੱਚ ਆਈ ਟੀ ਸੈਕਟਰ ਵੀ ਕਾਫੀ ਹੱਦ ਤੱਕ ਵਿਕਸਤ ਹੈ ਪਰੰਤੂ ਜਿਹੜਾ ਆਹਾ ਐਗਰੀਕਲਚਰ ਬੇਸਡ ਜਿਹੜਾ ਆਪਣੇ ਕੋਲ ਸੈਕਟਰ ਹੈ ਐਗਰੀਕਲਚਰ ਸੈਕਟਰ ਹੈਗੇ ਜਿਹੜਾ ਉਹ ਜ਼ਿਆਦਾ ਵਿਕਸਤ ਹੈ ਧੰਨਵਾਦ